ਸਰ ਮੈਂ ਜਗਬਾਣੀ ਅਖ਼ਬਾਰ ਤੋਂ ਬੋਲ ਰਿਆਂ ਰਿਪੋਟਰ ਬੋਲ ਰਿਆਂ ਜੀ ਸਰ ਤੁਸੀਂ ਸ਼੍ਰੀ ਮੁਕਤਸਰ ਸਾਹਿਬ ਵਿੱਚ ਰਹਿੰਦੇ ਓ ਤੇ ਉਹਦੇ ਵਿਕਾਸ ਵਿਕਾਸ ਤੇ ਹੋਣ ਵਾਲੀਆਂ ਕੁਝ ਗੱਲਾਂ ਬਾਰੇ ਤੁਸੀਂ ਦੱਸ ਸਕਦੇ ਅੱਛਾ ਜੀ

ਹਾਂਜੀ ਹਾਂਜੀ ਅੱਛਾ ਜੀ ਰੋਡ ਰੁਡ ਜਿਵੇਂ ਆਪਾਂ ਕਹਿ ਸਕਦੇ ਸਭਾ ਅ ਵਧੀਆ ਬਣੇ ਅੱਛਾ ਜੀ ਹਾਂਜੀ ਅੱਛਾ ਜੀ ਜੀ ਹੋਸਪੀਟਲਸ ਬਾਰੇ ਤੁਸੀਂ ਦੱਸ ਸਕਦੇ ਜੀ ਹੋਸਪੀਟਲਸ ਬਾਰੇ ਵੀ ਕੀ ਕੁਝ ਇੰਪਰੂਵਮੈਂਟ ਹੋਈ ਐ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਆਪਣਾ ਜਿਵੇਂ ਆਪਾਂ ਵੀ ਆਪਣਾ ਸਰਕਾਰੀ ਕੰਮਾਂ ਚ ਕਿੰਨੀ ਕ ਥੋੜੀ ਡਿਟੇ ਡਿਲੇ ਹੁੰਦਾ ਕੰਮ ਕੇ ਜਲਦੀ ਹੋ ਜਾਂਦਾ ਜੀ

ਅੱਛਾ ਜੀ ਤੇ ਹੋਰ ਆਪਾਂ ਹਾਂਜੀ ਪੈਨਸ਼ਨਸ ਕੀ ਆਪਾਂ ਸਾਰਿਆਂ ਨੂੰ ਮਿਲ ਰਹੀ ਐ ਜਾਂ ਆਪਾਂ ਕਹਿ ਸਕਦੇ ਆਂ ਉਨ੍ਹਾਂ ਦੇ ਬਜੁਰਗਾਂ ਬਾਰੇ ਕਿੰਨਾ ਕ ਡਿਵੈਲਪ ਕੇ ਆਪਾਂ ਕਹਿ ਸਕਦੇ ਆਂ ਕਿੰਨੇ ਕ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਤੇ ਆਪਾਂ ਸਿਨਮੇ ਸਿਨਮੇ ਦੇ ਘਰ ਦੇ ਬਾਰੇ ਕਿੰਨੇ ਕ ਆਪਾਂ ਕਹਿ ਸਕਦੇ ਆਂ ਵੀ ਤਰੱਕੀ ਹੋਈ ਐ ਸਿਨਮੇ ਘਰ ਵਿੱਚ ਅੱਛਾ ਜੀ ਅੱਛਾ ਜੀ ਅੱਛਾ ਜੀ

ਹਾਂਜੀ ਤੇ ਨਈਂ ਕ ਕਮੀਆਂ ਵੀ ਬਾਰੇ ਤੁਸੀਂ ਥੋੜ੍ਹਾ ਜਿਆ ਚਾਨਣਾ ਪਾਓ ਕਮੀਆਂ ਬਾਰੇ ਹਾਂਜੀ ਹਾਂਜੀ ਹਾਂਜੀ

ਕੋਈ ਨੀ ਜੋ ਥੋਡੇ ਜੋ ਥੋਡੀਆਂ ਜਿਵੇਂ ਤੁਸੀਂ ਵਿਕਾਸ ਬਾਰੇ ਦੱਸਿਆ ਕਮੀਆਂ ਬਾਰੇ ਦੱਸਿਆ ਉਨ੍ਹਾਂ ਨੂੰ ਅਸੀਂ ਲਿਖਤੀ ਰੂਪ ਵਿੱਚ ਅਖ਼ਬਾਰ ਵਿੱਚ ਛਾਪਣ ਦੀ ਛਾਪਾਂਗੇ ਤੇ ਸਰਕਾਰ ਨੂੰ ਬੇਨਤੀ ਕਰਾਂਗੇ ਬਹੁਤ ਵਧੀਆ ਲੱਗਿਆ ਜੀ ਥੋਡੇ ਨਾਲ ਗੱਲ ਕਰਕੇ ਥੈਂਕਿਊ ਸਰ